ਹੈਲੋ ਸਾਹਿਲ ਕਿਵੇਂ ਹੈ ਮੈਂ ਵਰਿੰਦਰ ਹਾਂ ਹਾਂ ਵਧੀਆ ਤੂੰ ਦੱਸ ਪੇਪਰ ਤਾਂ ਵਧੀਆ ਹੋ ਗਏ ਪਰ ਇੱਕ 'ਚ ਕੰਮ ਖ਼ਰਾਬ ਹੋ ਗਿਆ

ਔਖਾ ਤਾਂ ਆਇਆ ਸੀਗਾ ਬਸ ਫਿਜਿਕਸ 'ਚ ਥੋੜ੍ਹੇ ਜਿਹੇ ਘੱਟ ਨੰਬਰ ਆ ਗਏ

ਨਹੀਂ ਫੇਲ ਤਾਂ ਨਹੀਂ ਆ ਬਸ ਪਾਸਿੰਗ ਮਾਕਸ ਤਾਂ ਆ ਗਏ ਨੇ ਪਰ ਘਰ ਦੇ ਥੋੜ੍ਹੀ ਗੁੱਸੇ ਦੇ ਹੈਗੇ ਨੇ ਨਾ ਹਾਂ ਯਾਰ ਮਿਹਨਤ ਤਾਂ ਕੀਤੀ ਸੀਗੀ ਹਰ ਵਾਰੀ ਕੀਤੀ ਆ ਹਰ ਵਾਰੀ ਵਧੀਆ ਇਹਨੇ ਪਰ ਇਸ ਇਸ ਵਾਰ ਨਹੀਂ ਵਧੀਆ ਆਏ ਯਾਰ ਸਮਝ ਤਾਂ ਆਉਂਦੀ ਹੈ ਬਸ ਕਈ ਵਾਰ ਸਿਰ ਤੋਂ ਉੱਤੇ ਨਿਕਲ ਜਾਂਦੀ ਹੈ ਹੁਣ ਸੋਚ ਰਹੇ ਆ ਤੇਰੀ ਤੇਰੇ ਏਰੀਏ 'ਚ ਜਾਂ ਤੇਰੇ ਨਾਨ 'ਚ ਕੋਈ ਹੈਗਾ ਜਿਹੜਾ ਇੰਸਟੀਟਿਊਟ ਵਗੈਰਾ ਹੋਵੇ ਹਾਂ ਹਾਂ ਅੱਛਾ ਅੱਛਾ ਅਮਨ ਸਰ ਓਹੀ ਹੈ ਨਾ ਜਿਨ੍ਹਾਂ ਨੂੰ ਹੁਣੇ ਆਹ ਟੀਚਰ ਆਫ ਦਾ ਈਅਰ ਮਿਲਿਆ ਆਪਣੇ ਸਕੂਲ 'ਚ ਅੱਛਾ ਤੂੰ ਵੀ ਉਹਨਾਂ ਦੇ ਕੋਲੋਂ ਪੜ੍ਹਦਾ ਵਾ ਅੱਛਾ

ਅੱਛਾ ਯਾਰ ਆਪਣੀ ਤਾਂ ਛੁੱਟੀ ਦਾ ਲੇਟ ਹੁੰਦੀ ਹੈ ਤਾਂ ਸਾਨੂੰ ਟਾਈਮ ਕਿੱਥੇ ਮਿਲਦਾ ਹੋਵੇਗਾ ਨਾਲੇ

ਅੱਛਾ ਅੱਛਾ ਚੱਲ ਮੈਂ ਦੇਖਦਾ ਬਾਕੀ ਮੈਂ ਅੱਜ ਪੇਰੈਂਟਸ ਤੋਂ ਬਾਅਦ ਵਗੈਰਾ ਕਰਕੇ ਤੈਨੂੰ ਦੱਸ ਦਿੰਦਾ ਠੀਕ ਹੈ ਨਾ

ਹਾਂ ਭਰਾਵਾ ਮੈਥ 'ਚ ਵੀ ਮਤਲਬ ਇਸ ਵਾਰ ਤਾਂ ਵਧੀਆ ਨੰਬਰ ਆਏ ਨੇ ਪਰ ਫਾਈਨੈਂਸ ਦੇ ਕੀ ਪਤਾ ਹੈ ਨਾ ਚੱਲ ਫਿਰ ਠੀਕ ਮਿਲਦੇ ਆ ਕੱਲ੍ਹ ਨੂੰ